ਵੈਸੇ ਤਾਂ ਵਿਆਹਾਂ ਵਿੱਚ ਆਨੰਦ ਮਾਨਣ ਦੇ ਕਾਫ਼ੀ ਤਰੀਕੇ ਹਨ ਜਿਵੇਂ ਵਿਆਹ ਦੀਆਂ ਕਾਫ਼ੀ ਰ ਰਸਮਾਂ ਰੀਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਸ ਵਿੱਚ ਲੋਕਾਂ ਨੂੰ ਕਾਫ਼ੀ ਆਨੰਦ ਆਉਂਦਾ ਹੈ ਜਿਵੇਂ ਰਿਬਨ ਕਟਾਈ ਜੁੱਤਾ ਛੁਪਾਈ ਇਸ ਤੋਂ ਇਲਾਵਾ ਵਿਆਹਾਂ ਵਿੱਚ ਨੱਚ ਟੱਪ ਕੇ ਡਾਂਸ ਕਰਕੇ ਵੀ ਆਪਾਂ ਕਾਫ਼ੀ ਆਨੰਦ ਮਣ ਮਾਣ ਸਕਦੇ ਹਾਂ ਇਸ ਤੋਂ ਇਲਾਵਾ ਵਿਆਹਾਂ ਵਿੱਚ ਖਾਣਾ ਪੀਣਾ ਦੋਸਤਾਂ ਨੂੰ ਮਿਲਣਾ ਅਤੇ ਆਪਣੇ ਪਰਿਵਾਰਾਂ ਨਾਲ਼ ਮਿਲ ਕੇ ਫੋਟੋਆਂ ਖਿਚਵਾਉਣਾ ਇਹ ਵੀ ਇੱਕ ਆਨੰਦ ਦਾ ਬਹੁਤ ਵੱਡਾ ਤਰੀਕਾ ਹੈ ਇਸ ਤੋਂ ਇਲਾਵਾ ਇਹੋ ਜਿਹੇ ਗਾਣੇ ਜਿਹੜੇ ਡਾਂਸ ਲਈ ਵਧੀਆ ਹਨ ਮੇਰੇ ਹਿਸਾਬ ਨਾਲ਼ ਜੋ ਗਾਣਿਆਂ ਵਿੱਚ ਢੋਲ ਦੀ ਬੀਟ ਜ਼ਿਆਦਾ ਹੁੰਦੀ ਹੈ ਅਤੇ ਜੋ ਅੱਜ ਕੱਲ੍ਹ ਦੇ ਪੰਜਾਬੀ ਗੀਤਕਾਰ ਹਨ ਜਿਵੇਂ ਕਰਨ ਔਜਲਾ ਸਿੱਧੂ ਮੂਸੇਵਾਲਾ ਅਤੇ ਇਹੋ ਜਿਹੇ ਕਾਫ਼ੀ ਗੀਤਕਾਰ ਜੋ ਅੱਜ ਦੇ ਜ਼ਮਾਨੇ ਦੇ ਗਾਣਿਆਂ ਨੂੰ ਬਣਾ ਰਹੇ ਹਨ ਅਤੇ ਕਾਫ਼ੀ ਬੀਟ ਵਾਲੇ ਗਾਣੇ ਬਣਾਉਂਦੇ ਹਨ ਜਿਸ ਉੱਤੇ ਨੱਚ ਟੱਪ ਕੇ ਕਾਫ਼ੀ ਆਨੰਦ ਆਉਂਦਾ ਹੈ ਇਹੋ ਜਿਹੇ ਗਾਣੇ ਮੇਰੇ ਹਿਸਾਬ ਨਾਲ਼ ਡਾਂਸ ਕਰਨ ਲਈ ਬਹੁਤ ਹੀ ਵਧੀਆ ਰਹਿੰਦੇ ਹਨ ਜਿਨ੍ਹਾਂ ਉੱਤੇ ਡਾਂਸ ਕਰਕੇ ਸਾਨੂੰ ਆਨੰਦ ਤਾਂ ਆਉਂਦਾ ਹੀ ਹੈ ਨਾਲ਼ ਦੇ ਨਾਲ਼ ਸਾਨੂੰ ਗੀਤ ਵਿੱਚ ਗੀਤ ਸੁਣ ਕੇ ਵੀ ਬਹੁਤ ਮਜ਼ਾ ਆਉਂਦਾ ਹੈ ਇਸ ਕਰਕੇ ਇਹ ਗਾਣੇ ਮੇਰੇ ਪਸੰਦ ਵਿੱਚ ਕਾਫ਼ੀ ਵਧੀਆ ਹੁੰਦੇ ਹਨ